ਹਾਂਜੀ ਮੈਨੂੰ ਲਿਖਣਾ ਪਸੰਦ ਹੈ ਮੈਂ ਸੋਚ ਰਿਹਾ ਹਾਂ ਪੰਜਾਬੀ ਪ੍ਰਸਿੱਧ ਪਸਾਬੀ ਪੰਜਾਬੀ ਗਾਇਕ ਮਹਿਰੂਮ ਸਿੱਧੂ ਮੂਸੇਵਾਲਾ ਜਿਹੜੇ ਕਿ ਮਾਨਸਾ ਤੋਂ ਹਨ ਉਨ੍ਹਾਂ ਬਾਰੇ ਲਿਖਣਾ ਚਾਹੁੰਦਾ ਹਾਂ ਮੈਂ ਹਲੇ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਦੇ ਕਤਲ ਬਾਰੇ ਥੋੜ੍ਹਾ ਸ਼ੱਕ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਰੰਜਿਸ਼ ਕੋਈ ਕੁਛ ਵੀ ਤਰੀਕੇ ਨਾਲ਼ ਹੈ ਰੰਜਿਸ਼ ਸੀ ਉਨ੍ਹਾਂ ਦੀ ਕਿਵੇਂ ਉਨ੍ਹਾਂ ਦਾ ਤਾਂ ਕਤਲ ਹੋਇਆ ਧੋਖੇ ਨਾਲ ਹੋਇਆ ਜਾਂ ਸਰਕਾਰਾਂ ਦਾ ਕੰਮ ਸੀ ਕਿਵੇਂ ਕਿਸੇ ਗੈਂਗ ਨਾਲ਼ ਕੋਈ ਦੁਸ਼ਮਣੀ ਸੀ ਇਸ ਲਈ ਹੁਣ ਮੈਂ ਹਲੇ ਉਹਦੇ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹਾਂ ਸਮਾਂ ਆਊਗਾ ਮੈਂ ਉਨ੍ਹਾਂ ਬਾਰੇ ਹੋਰ ਜਾਣਕਾਰੀ ਐਨ ਸ਼ਿਉਰ ਹੋ ਕੇ ਹਰੇਕ ਕੰਮ 'ਚ ਕਿਵੇਂ ਦੇ ਸੀ ਕਿਵੇਂ ਦਾ ਬਚਪਨ ਸੀ ਕਿਵੇਂ ਦੀ ਜਵਾਨੀ ਕਿਵੇਂ ਦਾ ਉਨ੍ਹਾਂ ਦਾ ਕਨੇਡਾ ਦਾ ਸਫਰ ਅਤੇ ਕਿਵੇਂ ਗਾਇਕੀ ਦਾ ਸਫਰ ਉਨ੍ਹਾਂ ਦੇ ਮਾਂ ਬਾਪ ਤੋਂ ਵਾਰੇ ਗੱਲਬਾਤ ਕਰਕੇ ਹੌਲ਼ੀ ਹੌਲ਼ੀ ਉਨ੍ਹਾਂ ਦੇ ਪਿੰਡ ਤੋਂ ਏਰੀਏ ਤੋਂ ਉਨ੍ਹਾਂ ਦੇ ਨਾਲ਼ ਰਹਿੰਦੇ ਬੰਦੇ ਜਾਣਕਾਰੀ ਇਕੱਠੀ ਕਰਕੇ ਅਤੇ ਕਤਲ ਬਾਰੇ ਜਾਣਕਾਰੀ ਕਿਸੇ ਵੀ ਤਰੀਕੇ ਨਾਲ਼ ਉਨ੍ਹਾਂ 'ਤੇ ਜ਼ਰੂਰ ਕਿਤਾਬ ਲਿਖਾਂਗਾ ਵੀ ਹੌਲ਼ੀ ਪਰ ਮੈਂ ਹਲੇ ਹੋਰ ਜਾਣਕਾਰੀ ਇਕੱਠੀ ਕਰਨਾ ਹਲੇ ਸਮਾਂ ਲੈਣਾ ਚਾਹੁੰਦਾ ਵੀ ਉਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣ ਸਕਾਂ ਤਾਂ ਇਸ ਲਈ ਕਿਸੇ ਨੂੰ ਪੜ੍ਹਨ ਵਾਲ਼ੇ ਨੂੰ ਵੀ ਇੰਝ ਨਾਂ ਲੱਗੇ ਵੀ ਮੈਂ ਗਲਤ ਉਨ੍ਹਾਂ ਬਾਰੇ ਗਲਤ ਬੋਲ਼ ਰਿਹਾ ਹਾਂ ਕਿਉਂਕਿ ਮੈ ਉਨ੍ਹਾਂ ਦੇ ਗਾਣੇ ਉਨ੍ਹਾਂ ਦੇ ਗੀਤਕਾਰੀ ਉਨ੍ਹਾਂ ਦੇ ਜਜ਼ਬੇ ਨੂੰ ਬਹੁਤ ਪਸੰਦ ਕਰਦਾਂ ਇਸ ਲਈ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਹੋਰ ਲਿਖਣਾ ਚਾਹੁੰਦਾ ਹਾਂ ਉਨ੍ਹਾਂ ਬਾਰੇ